ਜਦੋਂ ਵੀ ਸਾਡੇ ਘਰ ਮਹਿਮਾਨ ਆਉਂਦੇ ਹਨ ਅਸੀਂ ਬਹੁਤ ਖੁਸ਼ ਹੁੰਦੇ ਹਾਂ ਅਤੇ ਬਹੁਤ ਵਧੀਆ ਤਰੀਕੇ ਨਾਲ ਪੇਸ਼ ਆਉਂਦੇ ਹਾਂ ਅਸੀਂ ਮਹਿਮਾਨਾਂ ਨੂੰ ਰੱਬ ਦਾ ਰੂਪ ਮੰਨਦੇ ਹਾਂ ਅਸੀਂ ਉਹਨਾਂ ਦੀ ਆਉਣ ਦੀ ਖੁਸ਼ੀ ਵਿੱਚ ਕਈ ਕਿਸਮ ਦੇ ਪਕਵਾਨ ਬਣਾਉਂਦੇ ਹਾਂ ਅਤੇ ਜਿਹਨਾਂ ਨੂੰ ਦੇਖ ਖਾ ਕੇ ਮਹਿਮਾਨ ਬਹੁਤ ਖੁਸ਼ ਹੁੰਦੇ ਹਨ ਅਤੇ ਮੈਨੂੰ ਪਕਵਾਨ ਬਣਾਉਣ ਦਾ ਵੀ ਬਹੁਤ ਸ਼ੌਂਕ ਹੈ ਅਸੀਂ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਬੈਠਦੇ ਹਾਂ ਹਾਸਾ ਮਜ਼ਾਕ ਚੱਲਦਾ ਹੈ ਬਹੁਤ ਖੁਸ਼ ਹੁੰਦੇ ਹਾਂ ਮਹਿਮਾਨ ਆਉਣ 'ਤੇ